ਬੋਲੀਵੁੱਡ ਨੇ ਭਾਰਤ ਵਿੱਚ ਹਰ ਥਾਂ ਫੈਸ਼ਨ ਰੁ ਰੁਝਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਕੁਝ ਫ਼ਿਲਮਾਂ ਦੇ ਪਾਤਰ ਹਨ ਜੋ ਜੋ ਕਿ ਕੱਪੜਿਆਂ ਦੀ ਸ਼ੈਲੀ ਨੂੰ ਪਸੰਦ ਕਰਦੇ ਹਨ ਅਮਰਿੰਦਰ ਗਿੱਲ ਗਿੱਪੀ ਗਰੇਵਾਲ ਦਲਜੀਤ ਦੋਸਾਂਝ ਐਮੀ ਵਿਰਕ ਤਰਸੇਮ ਜੱਸੜ ਅਤੇ ਕਈ ਫਿਲਮਾਂ ਹਨ ਜਿਸ ਵਿੱਚ ਸੋਨਮ ਬਾਜਵਾ ਨੇ ਪੰਜਾਬੀ ਸੂਟ ਬਹੁਤ ਵਧੀਆ ਪਾਏ ਹਨ ਉਹਨਾਂ ਦੀ ਸੋਨਮ ਬਾਜਵਾ ਦੀ ਡਰੈਸਿੰਗ ਸੈਂਸ ਇੰਨੀ ਵਧੀਆ ਹੁੰਦੀ ਹੈ ਕਿ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਿਸ ਕਰਕੇ ਮੈਂ ਉਸਦੀ ਡਰੈਸਿੰਗ ਡਰੈਸਾਂ ਮਤਲਬ ਸੂਟਸ ਪਾਉਣੇ ਬਹੁਤ ਪਸੰਦ ਕਰਦੀ ਹਾਂ ਮੈਂ ਉਸ ਤਰ੍ਹਾਂ ਦੇ ਸੂਟ ਬਣਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹਾਂ ਤਾਂ ਕਿ ਮੈਂ ਉਸ ਤਰ੍ਹਾਂ ਦੇ ਕੱਪੜੇ ਪਾ ਉਸ ਤਰ੍ਹਾਂ ਦੇ ਸੂਟ ਪਾ ਸਕਾਂ ਸੋਨਮ ਬਾਜਵਾ ਦੇ ਹਰ ਫਿਲਮ ਵਿੱਚ ਪੰਜਾਬੀ ਪਹਿਰਾਵਾ ਸੂਟ ਸਲਵਾਰ ਪਾਇਆ ਹੁੰਦਾ ਹੈ ਜੋ ਕਿ ਦੇਖਣ ਵਿੱਚ ਬਹੁਤ ਵਧੀਆ ਲੱਗਦਾ ਹੈ ਇਸ ਲਈ ਮੈਂ ਸਭ ਤੋਂ ਵੱਧ ਸੋਨਮ ਬਾਜਵਾ ਦੇ ਕੱਪੜੇ ਕ ਕੱਪੜੇ ਪੋ ਕੱਪੜਿਆਂ ਦੀ ਤਰ੍ਹਾਂ ਸੂਟ ਸਲਵਾਰ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਪਾਉਣ ਦੀ ਕੋਸ਼ਿਸ਼ ਕਰਦੀ ਹਾਂ ਵੀ ਇਸ ਤਰ੍ਹਾਂ ਦਾ ਸੂਟ ਪਾਇਆ ਜਾਵੇ ਮੈਨੂੰ ਉਸ ਦਾ ਡਰੈਸਿੰਗ ਸੈਂਸ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜੋ ਕਿ ਸਾਰੇ ਭਾਰਤ ਲਈ ਬਹੁਤ ਵਧੀਆ ਹੈ